ਪੱਚੀ ਸੱਤ ਦੋ ਹਜ਼ਾਰ ਨੌਂ ਤੀਹ ਨੌਂ ਦੋ ਹਜ਼ਾਰ ਛੇ ਇੱਕ ਇੱਕ ਦੋ ਹਜ਼ਾਰ ਪੰਜ ਪੰਜ ਸੱਤ ਦੋ ਹਜ਼ਾਰ ਇੱਕ ਸਤਾਈ ਨੌਂ ਦੋ ਹਜ਼ਾਰ ਅੱਠ